ਹੈਲੋ ਕੀ ਮੇਰੀ ਗੱਲ ਉਬਰ ਡਰਾਈਵਰ ਗੁਰਪ੍ਰੀਤ ਭਾਅ ਜੀ ਨਾਲ ਹੋ ਰਹੀ ਹੈ ਮੈਂ ਕੱਲ੍ਹ ਏਅਰਪੋਰਟ ਜਾਣ ਵਾਸਤੇ ਇੱਕ ਕੈਬ ਬੁੱਕ ਕੀਤੀ ਸੀ ਅਤੇ ਮੈਂ ਇਹ ਕਨਫਰਮ ਕਰਨ ਲਈ ਕਾਲ ਕੀਤੀ ਕਿ ਤੁਸੀਂ ਮੇਰੇ ਦੱਸੇ ਹੋਏ ਐਡਰੈਸ 'ਤੇ ਕਿਸ ਸਮੇਂ ਪਹੁੰਚੋਂਗੇ ਦਰਅਸਲ ਮੇਰੀ ਫਲਾਈਟ ਦਾ ਸਮਾਂ ਬਾਰਾਂ ਵਜੇ ਦਾ ਹੈ ਮੈਂ ਨਹੀਂ ਚਾਹੁੰਦੀ ਕਿ ਲੇਟ ਹੋਵਾਂ ਕਿਉਂਕਿ ਮੇਰੇ ਘਰ ਤੋਂ ਏਅਰਪੋਰਟ ਜਾਣ ਦਾ ਰਸਤਾ ਇੱਕ ਡੇਢ ਘੰਟੇ ਦਾ ਹੈ ਮੇਰਾ ਟਾਈਮ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਕੱਲ੍ਹ ਸਵੇਰੇ ਟਾਈਮ 'ਤੇ ਮੇਰੇ ਐਡਰੈਸ 'ਤੇ ਪਹੁੰਚ ਜਾਣਾ ਤਾਂ ਜੋ ਮੈਂ ਸਮੇਂ ਸਿਰ ਏਅਰਪੋਰਟ ਪਹੁੰਚ ਸਕਾਂ ਥੈਂਕ ਯੂ ਵੀਰ ਜੀ